ਸਾਡੇ ਖੇਤਰ ਵਿੱਚ ਲੋਕ ਬਹੁਤ ਸਾਰੇ ਬ੍ਰਾਂਡਾਂ ਦੇ ਫੋਨ ਨੂੰ ਟੈਲੀਫੋਨ ਨੂੰ ਯੂਸ ਕਰਦੇ ਹਨ ਜਿਹਨਾਂ ਵਿੱਚੋਂ ਇੱਕ ਹੈ ਸੈਮਸੰਗ ਮੈਂ ਐ ਆਈਫੋਨ ਨੂੰ ਯੂਸ ਕਰਦਾ ਹਾਂ ਐਪਲ ਫੋਨ ਨੂੰ ਯੂਸ ਕਰਦਾ ਹਾਂ ਅਤੇ ਇਹਦੀਆਂ ਬਹੁਤ ਸਾਰੀ ਵਿਦੇਸ਼ ਵਿਸ਼ੇਸ਼ਤਾਵਾਂ ਹਨ ਮੈਂ ਇਸ ਤੋਂ ਬਹੁਤ ਜ਼ਿਆਦਾ ਸੰਤੁਸ਼ਟ ਹਾਂ ਇਹ ਫੋਨ ਦਾ ਕੈਮਰਾ ਇੰਨਾ ਸ ਵਧੀਆ ਹੈ ਇਹਦੀ ਪਿਕਚਰ ਕੁਆਲਿਟੀ ਬਹੁਤ ਸੁੰਦਰ ਹੈ ਅਤੇ ਇਹਦਾ ਪ੍ਰੋਸੈਸਰ ਬਹੁਤ ਸੁੰਦਰ ਹੈ ਇਹਦੇ ਸਪੀਕਰ ਦੀ ਆਵਾਜ਼ ਬਹੁਤ ਕਲੀਅਰ ਅਤੇ ਸਾਫ ਸੁਣਦੀ ਹੈ ਮੈਂ ਇਸਦੇ ਰਾਹੀਂ ਬਹੁਤ ਜ਼ਿਆਦਾ ਸੰਤੁਸ਼ਟ ਹਾਂ ਇਹਦੀ ਡਿਸਪਲੇਅ ਇਹਦੀ ਇਹਦੀਆਂ ਸਾਰੀਆਂ ਚੀਜ਼ਾਂ ਹਰੇਕ ਫੋਨਾਂ ਨਾਲੋਂ ਉੱਪਰ ਹਨ ਇਸਦਾ ਇਹ ਬਹੁਤ ਨੰਬਰ ਵਨ ਬ੍ਰਾਂਡ ਚੱਲ ਰਿਹਾ ਹੈ ਇਸ ਲਈ ਮੈਂ ਆਪਣੇ ਫੋਨ ਤੋਂ ਬਹੁਤ ਖੁਸ਼ ਹਾਂ ਇਹਦੀਆਂ ਬਹੁਤ ਸਾਰੀ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਇਹ ਆਪਣੇ ਫੋਨ ਸਾਡੇ ਬਹੁਤ ਸਾਰਾ ਇਹੀ ਡਾਟਾ ਵੀ ਰੱਖਦਾ ਹੈ ਬਹੁਤ ਸਹੀ ਚੱਲਦਾ ਹੈ ਹੈਂਗ ਵੀ ਨਹੀਂ ਹੁੰਦਾ ਸਾਰੇ ਕੰਮ ਇਹਦੇ ਵਧੀਆ ਹਨ